ਹਾਂਜੀ ਕਿਆ ਹਾਲ ਹੈ ਜੀ ਹਾਂਜੀ ਮੈਨੂੰ ਨਾ ਮ ਮੇਰੇ ਗੁਆਂਢੀ ਨੇ ਤੁਹਾਡਾ ਨੰਬਰ ਦਿੱਤਾ ਮੈਂ ਇਹ ਇਸ ਥਾਂ 'ਤੇ ਨਵਾਂ ਰਹਿਣ ਆਇਆ ਹਾਂਜੀ ਅਤੇ ਮੈਂ ਨਾ ਸਬਜ਼ੀਆਂ ਖਰੀਦਣੀਆਂ ਸੀ ਜੀ ਤੁਸੀਂ ਦੱਸ ਸਕਦੇ ਇਥੇ ਸਬਜ਼ੀਆਂ ਸਬਜ਼ੀਆਂ ਕਿੱਥੇ ਵਧੀਆ ਮਿਲਦੀਆਂ ਨੇ ਕਿਹੜਾ ਦੁਕਾਨ ਵਧੀਆ ਹੈ ਅੱਛਾ ਜੀ ਅੱਛਾ ਮਤਲਬ ਕਿਹੋ ਜਿਹੀ ਸਬਜ਼ੀਆਂ ਹੁੰਦੀਆਂ ਵਧੀਆ ਫਰੈਸ਼ ਹੁੰਦੀਆਂ ਜੀ ਅੱਛਾ ਜੀ ਅੱਛਾ ਕਿਹੋ ਜਿਹੇ ਮਤਲਬ ਰੇਟ ਕਿਹੋ ਜਿਹੇ ਹੁੰਦੇ ਜੀ ਉਹਨਾਂ ਦੇ

ਅੱਛਾ ਜੀ

ਤੁਸੀਂ ਆਪ ਲੈਂਦੇ ਹੋ ਕਿ ਨਹੀਂ ਉਹਨਾਂ ਕੋਲੋਂ

ਵਧੀਆ ਹੁੰਦੀਆਂ ਸਬਜ਼ੀਆਂ ਉਹਨਾਂ ਦੀਆਂ ਅੱਛਾ ਜੀ ਅਤੇ ਵੈਸੇ ਜਿਹੜਾ ਆਪਣਾ ਕੀ ਕਹਿੰਦੇ ਉਹਨਾਂ ਦਾ ਜਿਹੜੇ ਸਬਜ਼ੀਆਂ ਨੇ ਜੇ ਖਰਾਬ ਹੋਵੇ ਤਾਂ ਮੋੜ ਮੋੜ ਲੈਂਦੇ ਕਿ ਨਹੀਂ ਮੋੜਦੇ ਵਾਪਸ ਕਰਦੇ ਕਿ ਨਹੀਂ ਅੱਛਾ ਠੀਕ ਹੈ ਜੀ ਜ ਜੇਕਰ ਤੁਹਾਡੇ ਕੋਲ ਟਾਈਮ ਹੋਇਆ ਨਾ ਤੁਸੀਂ ਮੈਨੂੰ ਦੱਸ ਦਿਉ ਸੁਜੈਸਟ ਕਰ ਦਿਉ ਤਾਂ ਤੁਹ ਤੁਸੀਂ ਲੈ ਕੇ ਜਾ ਸਕਦੇ ਹੋ ਤਾਂ ਵਧੀਆ ਗੱਲ ਹੈ ਅੱਛਾ ਜੀ ਠੀਕ ਹੈ ਜੇ ਮੈਨੂੰ ਵਧੀਆ ਲੱਗਿਆ ਤਾਂ ਲੈ ਲਵਾਂਗੇ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਮੈਂ ਆ ਕੇ ਤੁਹਾਨੂੰ ਫੋਨ ਕਰੂੰਗਾ